ਪੰਜਾਬੀ ਪਰਿਵਾਰ ਸੱਭਿਆਚਾਰ ਪਰੰਪਰਾਵਾਂ ਅਤੇ ਕਦਰਾਂ ਕੀਮਤਾਂ ਨੂੰ ਨੌਜਵਾਨ ਪੀੜ੍ਹੀ ਤੱਕ ਅਸੀਂ ਜਿਵੇਂ ਕਿ ਪਰਿਵਾਰ ਦੀ ਕੋਈ ਕਦਰ ਨਹੀਂ ਕਰਦੇ ਉਨ੍ਹਾਂ ਦੀ ਕੋਈ ਦੇਖਭਾਲ ਨਈਂ ਕਰਦੇ ਫੋਨ ਵਿੱਚ ਹੀ ਵਿਅਸਤ ਰਹਿੰਦੇ ਹਨ ਅਤੇ ਇੱਕ ਦੂਜੇ ਅੱਜ ਦੀ ਪੀੜ੍ਹੀ ਇੱਕ ਦੂਜੇ ਨਾਲ ਹੀ ਝਗੜਦੇ ਰਹਿੰਦੇ ਨੇ ਕਿਸੇ ਨਾਲ ਵੀ ਇਕੱਠੇ ਨਹੀਂ ਰਹਿੰਦੇ ਅੱਜ ਅਤੇ ਅੱਜ ਦੀ ਪੀੜ੍ਹੀ ਮਾਲਾਂ ਵਿੱਚ ਹੀ ਵਿਅਸਤ ਰਹਿੰਦੀਆਂ ਸਨ ਅਤੇ ਪਰਿਵਾਰ ਨੂੰ ਕੋਈ ਕਦਰ ਨਹੀਂ ਕਰਦੇ ਅਤੇ ਅੱਜ ਦੀ ਪੀੜ੍ਹੀ ਵੀ ਛੋਟੇ ਛੋਟੇ ਬੱਚਿਆਂ ਨੂੰ ਵੀ ਕੋਈ ਕਦਰ ਨਹੀਂ ਕਰਦੇ ਸਨ ਅਤੇ ਪੀੜ੍ਹੀ ਅੱਜ ਦੀ ਪੀੜ੍ਹੀ ਐਨੀ ਵੱਧ ਰਹੀ ਹੈ ਕੋਈ ਇਨ੍ਹਾਂ ਦੀ ਕੀਮਤ ਕਦਰ ਨਹੀਂ ਹੈ